ਸਤਿ ਸ਼੍ਰੀ ਅਕਾਲ ਮੈਂ ਐਮਾਜੋਨ ਤੋਂ ਇੱਕ ਓਡਰ ਮੰਗਵਾਇਆ ਸੀਗਾ ਉਹ ਓਡਰ ਇੱਕ ਜੈਕਟ ਸੀਗੀ ਜਦੋਂ ਉਹ ਜੈਕਟ ਮੇਰੇ ਕੋਲ ਪੁੱਜੀ ਉਸ ਦਾ ਰੰਗ ਵੀ ਉਹ ਨਹੀਂ ਸੀ ਜੋ ਮੈਂ ਮੰਗਵਾਇਆ ਸੀ ਅਤੇ ਨਾਲੇ ਉਹ ਫਟੀ ਵੀ ਸੀ ਜਦੋਂ ਮੈਂ ਉਸ ਨੂੰ ਵਾਪਸ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਬਹੁਤ ਸਾਰੀਆਂ ਮੂਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਿੱਦਾਂ ਕਿ ਪਹਿਲਾਂ ਤਾਂ ਕੰਪਨੀ ਮੰਨੀ ਹੀ ਨਹੀਂ ਕਿ ਅਸੀਂ ਇਹ ਪ੍ਰੋ਼ਡਕਟ ਗਲਤ ਭੇਜਿਆ ਹੈ ਉਸ ਤੋਂ ਬਾਅਦ ਜਦੋਂ ਮੰਨੀ ਤਾਂ ਉਨ੍ਹਾਂ ਨੇ ਕਾਫ਼ੀ ਟੈਮ ਲਾਇਆ ਉਸ ਨੂੰ ਵਾਪਸ ਕਰਨ 'ਚ ਅਤੇ ਜਦੋਂ ਵਾਪਸ ਕਰ ਕੇ ਆਇਆ ਫਿਰ ਮੈਨੂੰ ਇਹ ਹੀ ਸਮੱਸਿਆ ਆਈ ਅਤੇ ਉਸ ਤੋਂ ਬਾਅਦ ਜਾ ਕੇ ਕੰਪਨੀ ਨੇ ਉਸ ਸਮੱਸਿਆ ਨੂੰ ਹੱਲ ਕੀਤਾ ਇਹ ਮੇਰਾ ਬਹੁਤ ਹੀ ਮਾੜਾ ਐਕਸਪੀਰੀਐਂਸ ਸੀਗਾ ਮੈਂ ਤਾਂ ਇਹ ਹੀ ਕਹਾਂਗਾ ਕਿ ਹਮੇਸ਼ਾ ਜੋ ਵੀ ਤੁਸੀਂ ਅੋਨਲਾਈਨ ਖਰੀਦੀ ਕਰਦੇ ਹੋ ਉਹ ਦੇਖ ਕੇ ਅਤੇ ਜਾਂਚ ਪਰਚ ਪਰਖ ਕੇ ਕਰੋ